ਭਾਰਤ ਗਣਰਾਜ ਦੀਆਂ ਬਾਈ ਵੱਖ ਵੱਖ ਅਧਿਕਾਰਤ ਭਾਸ਼ਾਵਾਂ ਹਨ ਜਿਹਨਾਂ ਵਿੱਚ ਬਾਈ ਭਾਸ਼ਾਵਾਂ ਵਿੱਚੋਂ ਦੋ ਭਾਸ਼ਾਵਾਂ ਪੰਜਾਬੀ ਅਤੇ ਹਿੰਦੀ ਹਨ ਪੰਜਾਬੀ ਭਾਸ਼ਾ ਭਾਰਤ ਦੇ ਪੰਜਾਬ ਖੇਤਰ ਦੇ ਵਸਨੀਕਾਂ ਦੁਆਰਾ ਬੋਲੀ ਜਾਂਦੀ ਹੈ ਹਿੰਦੀ ਭਾਰਤ ਦੀ ਇੱਕਤਾਲੀ ਪ੍ਰਤੀਸ਼ਤ ਆਬਾਦੀ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਹੈ ਦੋਵਾਂ ਭਾਸ਼ਾਵਾਂ ਦੀਆਂ ਆਪਣੀਆਂ ਸਮਾਨਤਾਵਾਂ ਅਤੇ ਅਸਮਾਨਤਾ ਹਨ ਪੰਜਾਬੀ ਪੰਜਾਬੀ ਪੰਜਾਬ ਖੇਤਰ ਦੇ ਮੂਲ ਨਿਵਾਸੀਆਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਹੈ ਵਰਤਮਾਨ ਵਿੱਚ ਪੰਜਾਬ ਖੇਤਰ ਵਿੱਚ ਭਾਰਤ ਗਣਰਾਜ ਦਾ ਉੱਤਰੀ ਪੱਛਮੀ ਖੇਤਰ ਅਤੇ ਇਸਲਾਮਿਕ ਗਣਰਾਜ ਪਾਕਿਸਤਾਨ ਦੇ ਪੂਰਵੀ ਹਿੱਸੇ ਸ਼ਾਮਿਲ ਹਨ ਦੋ ਹਜ਼ਾਰ ਅੱਠ ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਭਗ ਇਕ ਸੌ ਚਾਰ ਮਿਲੀਅਨ ਹੈ ਇਸ ਵਿੱਚੋਂ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਸਭ ਤੋਂ ਵੱਡੀ ਆਬਾਦੀ ਪਾਕਿਸਤਾਨ ਵਿੱਚ ਰਹਿੰਦੀ ਹੈ ਜੋ ਕਿ ਲਗਭਗ ਛਿਹੱਤਰ ਮਿਲੀਅਨ ਹੈ ਅਤੇ ਦੂਜੀ ਸਭ ਤੋਂ ਵੱਡੀ ਆਬਾਦੀ ਅਠਾਈ ਮਿਲੀਅਨ ਬੋਲਣ ਵਾਲਿਆਂ ਦੀ ਹੈ ਬਾਕੀ ਆਬਾਦੀ ਯੂਨਾਈਟਡ ਕਿੰਗਡਮ ਫਾਰਸ ਆਦਿ ਖਾੜੀ ਕਨੇਡਾ ਅਮਰੀਕਾ ਮਲੇਸ਼ੀਆ ਮਿਆਂਮਾਰ ਹਾਂਗਕਾਂਗ ਅਤੇ ਬਹੁਤ ਸਾਰੇ ਦੇਸ਼ਾਂ ਵਿੱਚ ਫੈਲੀ ਹੋਈ ਹੈ ਦੁਨੀਆਂ ਦੀਆਂ ਸਭ ਤੋਂ ਵੱਧ ਬੋਲਣ ਵਾਲੀਆਂ ਭਾਸ਼ਾਵਾਂ ਦੀ ਸੂਚੀ ਵਿੱਚ ਪੰਜਾਬੀ ਦਸਵਾਂ ਸਥਾਨ ਰੱਖਦੀ ਹੈ ਪੰਜਾਬੀ ਭਾਸ਼ਾ ਲਿਖਣ ਲਈ ਕਈ ਲਿਪੀਆਂ ਦੀ ਵਰਤੋਂ ਕਰਦੀ ਹੈ ਇਸ ਖੇਤਰ ਅਤੇ ਧਰਮ 'ਤੇ ਨਿਰਭਰ ਕਰਦਾ ਹੈ ਇਹ ਕਿਵੇਂ ਲਿਖਿਆ ਗਿਆ ਹੈ ਪਾਕਿਸਤਾਨ ਵਿੱਚ ਲਿਪੀ ਸ਼ਾਹਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਭਾਰਤ ਦਾ ਪੰਜਾਬ ਖੇਤਰ ਪੰਜਾਬੀ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕਰਦਾ ਹੈ ਭਾਰਤ ਦੇ ਹੋਰ ਸਥਾਨਾਂ ਵਿੱਚ ਇਸ ਭਾਸ਼ਾ ਨੂੰ ਲਿਖਣ ਲਈ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਦੀਆਂ ਤਿੰਨ ਪਿ ਰੂਪ ਰੇਖਾਵਾਂ ਹਨ ਉੱਚ ਨੀਵਾਂ ਅਤੇ ਪੱਧਰ ਹਿੰਦੀ ਭਾਰਤੀਆਂ ਦੀ ਮੁੱਢਲੀ ਰਸਮੀ ਸ਼ਬਦਾਵਲੀ ਹੈ ਇਸ ਵਿੱਚ ਲਗਭਗ ਇੱਕਤਾਲੀ ਪ੍ਰਤੀਸ਼ਤ ਵਸਨੀਕਾਂ ਦੁਆਰਾ ਵਰਤਿਆ ਜਾਂਦਾ ਹੈ ਹਿੰਦੀ ਦੀ ਜ਼ਬਾਨੋਂ ਜ਼ਬਾਨੀ ਵਰਤੋਂ ਮੁੱਖ ਤੌਰ 'ਤੇ ਦੇਸ਼ ਦੇ ਉੱਤਰੀ ਖੇਤਰਾਂ ਵਿੱਚ ਰਾਜਸਥਾਨ ਦਿੱਲੀ ਉੱਤਰਾਖੰਡ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਛੱਤੀਸਗੜ੍ਹ ਬਿਹਾਰ ਝਾਰਖੰਡ ਹਿਮਾਚਲ ਪ੍ਰਦੇਸ਼ ਹਿੰਦੂ ਨੇ ਨੇਪਾਲ ਬੰਗਲਾਦੇਸ਼ ਪਾਕਿਸਤਾਨ ਅਤੇ ਫਿਜੀ ਵਰਗੇ ਦੇਸ਼ਾਂ ਵਿੱਚ ਜ਼ਬਾਨੀ ਮਾਨਤਾ ਪ੍ਰਾਪਤ ਵੀ ਹੈ ਹਿੰਦੀ ਦੇਵਨਾਗਰੀ ਲਿਪੀ ਦੀ ਪਾਲਣਾ ਕਰਦੀ ਹੈ ਦੇਵਨਾਗਰੀ ਲਿਪੀ ਜਿਸ ਨੂੰ ਆਮ ਤੌਰ 'ਤੇ ਨਾਗਰੀ ਵਜੋਂ ਜਾਣਿਆ ਜਾਂਦਾ ਹੈ ਖੱਬੇ ਤੋਂ ਸੱਜੇ ਪ੍ਰਕਾਸ਼ਤ ਹੁੰਦੀ ਹੈ ਹਿੰਦੀ ਵਿੱਚ ਅੱਖਰਾਂ ਨੂੰ ਹਰੇਕ ਸ਼ਬਦ ਵਿੱਚ ਇੱਕ ਲਾਇਨ ਦੁਆਰਾ ਸਿਖਰ 'ਤੇ ਰੱਖਿਆ ਜਾਂਦਾ ਹੈ ਇਹ ਪੰਜਾਬੀ ਨਾਲ ਬਹੁਤ ਮਿਲਦਾ ਜੁਲਦਾ ਹੈ ਹਿੰਦੀ ਦੇ ਵਰਤਮਾਨ ਰੂਪ ਨੂੰ ਸਟੈਂਡਰਡ ਹਿੰਦੀ ਕਿਹਾ ਜਾਂਦਾ ਹੈ ਇਸ ਨੂੰ ਭਾਸ਼ਾ ਦੀ ਦੁਨੀਆਂ ਵਿੱਚ ਲਗਭਗ ਇਕ ਸੌ ਅੱਸੀ ਮਿਲੀਅਨ ਬੋਲਣ ਵਾਲੇ ਹਨ ਭਾਸ਼ਾ ਵਿੱਚ ਇੱਕ ਵਿਸਰਿਤ ਸਹਿਤ ਹੈ ਜੋ ਗੱਦਿਆ ਜਾਂ ਵਰਤਿਆ ਪੜ੍ਹਿਆ ਜਾਂ ਕਵਿਤਾ ਵਿੱਚ ਵੰਡਿਆ ਗਿਆ ਹੈ ਪੰਜਾਬੀ ਭਾਰਤ ਦੀ ਬਾਈ ਰਾਸ਼ਟਰੀ ਭਾਸ਼ਾਵਾਂ ਵਿੱਚੋਂ ਇੱਕ ਹੈ ਜਦਕਿ ਹਿੰਦੀ ਨੂੰ ਭਾਰਤ ਦੀ ਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ ਪੰਜਾਬੀ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ ਜਦਕਿ ਹਿੰਦੀ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ ਦੋਵਾਂ ਦੀ ਸ਼ਬਦਾਵਲੀ ਵਿਆਕਰਨ ਵਿਰਾਮ ਚਿੰਨ੍ਹਾਂ ਦੀ ਇੱਕ ਵੱਖਰੀ ਸ਼ੈਲੀ ਹੈ